ਕਾਰੋਬਾਰ ਸ਼ੁਰੂ ਕਰਨ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਵਾਂ ਆਉਂਦੀਆਂ ਹਨ ਸਭ ਤੋਂ ਵੱਡੀ ਅਤੇ ਅਹਿਮ ਮੁਸ਼ਕਿਲ ਹੈ ਰਾਸ਼ੀ ਅਸੀਂ ਰਾਸ਼ੀ ਦਾ ਪ੍ਰਬੰਧ ਕਿਵੇਂ ਕਰ ਸਕਦੇ ਹਾਂ ਜੇ ਅਸੀਂ ਆਪਣੀ ਰਾਸ਼ੀ ਦਾ ਪ੍ਰਬੰਧ ਬੈਂਕ ਦੇ ਰਾਹੀਂ ਕਰਵਾਉਣ ਕਰਵਾਉਂਦੇ ਹਾਂ ਤਾਂ ਸਾਨੂੰ ਬਹੁਤ ਹੀ ਬਹੁਤ ਸਾਰੇ ਕਾਗਜ਼ੀ ਕਾਰਵਾਈ ਕਰਨੀ ਪੈਂਦੀ ਹੈ ਅਤੇ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਹੋਰ ਬਹੁਤ ਸਾਰੀਆਂ ਆਰਥਿਕ ਮੁਸ਼ਕਿਲਾਵਾਂ ਆਉਂਦੀਆਂ ਹਨ ਜਿਸ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੀ ਜਗ੍ਹਾ ਦੀ ਲੋੜ ਪੈਂਦੀ ਹੈ ਉਸ ਤੋਂ ਬਾਅਦ ਅਸੀਂ ਜੋ ਬਣਾਉਣਾ ਹੈ ਉਸ ਦੀਆਂ ਮਸ਼ੀਨਾਂ ਆਦਿ ਇਕੱਠੀਆਂ ਕਰਨ ਦੇ ਵਿੱਚ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਉਸ ਤੋਂ ਬਾਅਦ ਅਸੀਂ ਕਾਰੋਬਾਰ ਨੂੰ ਸ਼ੁਰੂ ਕਰਨ ਦੇ ਲਈ ਸਾਨੂੰ ਮਨੁੱਖੀ ਪਾਵਰ ਨੂੰ ਇਕੱਠਾ ਕਰਨ ਵਿੱਚ ਕਾਫੀ ਦਿੱਕਤ ਆਉਂਦੀ ਹੈ ਉਸ ਤੋਂ ਬਾਅਦ ਸਾਨੂੰ ਆਪਣਾ ਜੋ ਪਦਾਰਥ ਅਸੀਂ ਬਣਾ ਰਹੇ ਹਾਂ ਉਸਨੂੰ ਕਿਵੇਂ ਲੋਕਾਂ ਤੱਕ ਲਿਜਾਈਏ ਅਤੇ ਕਿਵੇਂ ਲੋਕਾਂ ਨੂੰ ਉਸ ਬਾਰੇ ਜਾਣੂ ਕਰਵਾਈਏ ਇਸ ਦੇ ਵਿੱਚ ਵੀ ਕਾਫੀ ਮੁਸ਼ਕਿਲਾਵਾਂ ਆਉਂਦੀਆਂ ਹਨ ਵੱਡੇ ਕਾਰੋਬਾਰ ਵਿੱਚ ਸਰਟੀਫਿਕੇਸਨ ਲੈਣ ਦੇ ਲਈ ਸਾਨੂੰ ਬਕਾਇਦਾ ਸਰਕਾਰ ਵੱਲੋਂ ਪਰਮਿਸ਼ਨ ਲੈਣੀ ਪੈਂਦੀ ਹੈ ਜਿਸ ਦੇ ਨਾਲ ਅਸੀਂ ਆਪਣਾ ਕਾਰੋਬਾਰ ਸ਼ੁਰੂ ਕਰ ਸਕੀਏ ਅਤੇ ਸਰਕਾਰ ਨੂੰ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਸਾਡੇ ਪੂਰੇ ਕਾਰੋਬਾਰ ਦਾ ਵੇਰਵਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਹੀ ਉਹ ਸਾਨੂੰ ਸਰਟੀਫਿਕੇਸ਼ਨ ਪ੍ਰਦਾਨ ਕਰਦੇ ਹਨ